ਸਾਡਾ ਭਾਰਤ ਦੇਸ਼ ਵੱਖ ਵੱਖ ਸਮੂਹਾਂ ਧਰਮ ਅਤੇ ਜਾਤੀਆਂ ਦਾ ਸਮੂਹ ਹੈ ਇਸ ਸਮੂਹ ਦੇ ਕਾਰਣ ਜਿਹੜਾ ਸਾਡਾ ਭਾਰਤ ਦੇਸ਼ ਹੈ ਉਹ ਕਾਫ਼ੀ ਭਾਈਚਾਰੇ ਵਾਲਾ ਹੈ ਇਸ ਕਰਕੇ ਮੈਂ ਕਿਸੇ ਇੱਕ ਇਲਾਕੇ ਦਾ ਖਾਣਾ ਬਣਾਉਣਾ ਪਸੰਦ ਨਹੀਂ ਕਰਾਂਗੀ ਮੈਂ ਸਾਰਿਆਂ ਦਾ ਹੀ ਕਰਨਾ ਚਾਹਵਾਂ ਕਿਉਂਕਿ ਹਰ ਇੱਕ ਇਲਾਕੇ ਦਾ ਖਾਣਾ ਆਪਣੀ ਆਪਣੀ ਇਲਾਕੇ ਦੀ ਜਿਹੜੀ ਪ੍ਰਸਿੱਧਤਾ ਹੈ ਉਹਨੂੰ ਦਰਸਾਉਂਦਾ ਹੈ ਅਤੇ ਉਹਨਾਂ ਦਾ ਪਿਆਰ ਵਿਅਕਤ ਕਰਦਾ ਹੈ ਅਤੇ ਹਰ ਇੱਕ ਭੋਜਨ ਦੇ ਪਿੱਛੇ ਆਪਣੀ ਕਹਾਣੀ ਹੁੰਦੀ ਹੈ ਇੱਕ ਪਿਆਰ ਹੁੰਦਾ ਹੈ ਆਪਣੇ ਪਰਿਵਾਰ ਨੂੰ ਖਿਲਾਉਣ ਲਈ ਉਹਨਾਂ ਦੀ ਭਾਵਨਾ ਹੁੰਦੀ ਹੈ ਅਤੇ ਖਾਣਾ ਬਣਾਉਣਾ ਇੱਕ ਬਹੁਤ ਹੀ ਭਾਵਨਾਮੇ ਕੰਮ ਹੁੰਦਾ ਹੈ ਜਦੋਂ ਅਸੀਂ ਅਪ ਅਗਲੇ ਬੰਦੇ ਦਾ ਪੇਟ ਭਰਦੇ ਹਾਂ ਖਾਣਾ ਬਣਾਉਣ ਵਿੱਚ ਖਾਣਾ ਬਣਾਉਣ ਵਿੱਚ ਕਾਫ਼ੀ ਆਨੰਦ ਵੀ ਆਉਂਦਾ ਹੈ ਅਤੇ ਉਹਨੂੰ ਖਾਣ ਵਿੱਚ ਵੀ ਕਾਫ਼ੀ ਮਜ਼ਾ ਆਉਂਦਾ ਹੈ ਜਦੋਂ ਅਸੀਂ ਗੱਲ ਕਰੀਏ ਅਲੱਗ ਅਲੱਗ ਇਲਾਕੇ ਦੀ ਖਾਣੇ ਦੀ ਤਾਂ ਉੱਤਰੀ ਭਾਰਤ ਵੀ ਕਾਫ਼ੀ ਵਧੀਆ ਹੈ ਅਤੇ ਦੱਖਣੀ ਭਾਰਤ ਵੀ ਉਹਨਾਂ ਵਿੱਚ ਕੋਈ ਫ਼ਰਕ ਨਹੀਂ ਹੈ ਬਸ ਇਹ ਹੈ ਕਿ ਉਹਨਾਂ ਦੀ ਇਲਾਕਿਆਂ ਦੀ ਖਾਣ ਦੇ ਭੋਜਨ ਦੇ ਤਰੀਕੇ ਅਲੱਗ ਨੇ ਅਤੇ ਉਹਨਾ ਦੇ ਖਾਣਾ ਪੀਣਾ ਅਲੱਗ ਹੈ ਕਈ ਜਗ੍ਹਾ 'ਤੇ ਇੱਦਾਂ ਵੀ ਹੁੰਦਾ ਹੈ ਕਿ ਖਾਣਾ ਤਾਂ ਉਹ ਹੀ ਹੁੰਦਾ ਪਰ ਉਹਨਾਂ ਦਾ ਨਾਮ ਅਲੱਗ ਅਲੱਗ ਹੋ ਜਾਂਦਾ ਤਾਂ ਉਹ ਇਲਾਕਿਆਂ ਦੇ ਕਾਰਣ ਉਹਨਾਂ ਦੇ ਵਿੱਚ ਜਿਹੜੀ ਹੈ ਅਲੱਗ ਵਿਭਿੰਨਤਾ ਆ ਜਾਂਦੀ ਹੈ ਪਰ ਇੱਦਾਂ ਦਾ ਨਹੀਂ ਹੁੰਦਾ ਹਰ ਇੱਕ ਖਾਣਾ ਇੱਕ ਆਪਣੀ ਰਾਜਾਂ ਦੀ ਉਹਨੂੰ ਦਰਸਾਉਂਦਾ ਹੈ